ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਅਸੀਂ ਇੱਥੇ ਹਰਿਆਣੇ ਤੋਂ ਆਏ ਹਾਂ ਪੰਜਾਬ ਵਿੱਚ ਇੱਥੋਂ ਦੇ ਸਿੱਖ ਧਰਮ ਬਾਰੇ ਕੁਝ ਸਾਨੂੰ ਦੱਸੋ ਹਾਂਜੀ ਹਾਂਜੀ ਠੀਕ ਹੈ ਹਾਂਜੀ ਅੱਛਾ ਜੀ ਬਹੁਤ ਵਧੀਆ ਤੁਹਾਡਾ ਸਿੱਖ ਧਰਮ ਬਾਰੇ ਜਾਣ ਕੇ ਬੜਾ ਵਧੀਆ ਲੱਗਾ ਸਾਨੂੰ ਹਾਂਜੀ ਤੁਸੀਂ ਆਪਣੀ ਸਿੱਖੀ ਨਾਲ ਜੁੜੇ ਜੋ ਬਹੁਤ ਪਿਆਰ ਕਰਦੇ ਆਪਣੇ ਗੁਰੂਆਂ ਨਾਲ ਠੀਕ ਆ ਓਕੇ ਮੈਮ